ਹਾਂਜੀ ਨਮਸਕਾਰ ਮੈਡਮ ਜੀ ਮੈਡਮ ਜੀ ਮੈਂ ਤੁਹਾਡੇ ਨਾਲ ਸਵੇਰੇ ਮਿਲਿਆ ਸੀ ਤੁਸੀਂ ਡਿਸਕਸ ਕਰਨਾ ਸੀ ਸ਼ਾਮੀ ਫੋਨ 'ਤੇ ਡਿਸਕਸ ਕਰਾਂਗੇ ਬੱਚਿਆ ਦੀ ਮੈਂ ਐਕਚੁਲੀ ਬੱਚੇ ਨੂੰ ਅਡਮਿਸ਼ਨ ਕਰਵਾਉਣਾ ਸੀ ਅਤੇ ਬੈਸਟ ਸਕੂਲ ਆਪਣੇ ਗੁਰਦਾਸਪੁਰ 'ਚ ਬੈਸਟ ਸਕੂਲ ਕਿਹੜੇ ਹੈਗੇ ਹੈ ਤੁਸੀਂ ਕਹਿੰਦੇ ਸੀ ਦੱਸੋਂਗੇ ਸ਼ਾਮ ਨੂੰ ਦੂਨ ਇੰਟਰਨੈਸ਼ਨਲ ਹਾਂਜੀ ਓਕੇ ਜੀ ਓਕੇ ਮਹਿੰਗਾ ਤਾਂ ਠੀਕ ਹੈ ਜੀ ਅਤੇ ਆਰਮੀ ਸਕੂਲ 'ਚ ਕੀ ਫਸਿਲਿਟੀਆਂ ਹੈਗੀਆਂ

ਆਰਮੀ ਸਕੂਲ ਆਰਮੀ ਸਕੂਲ ਦੇ ਟੀਚਰ ਪ੍ਰਾਈਵੇਟ ਹੁੰਦੇ ਆ ਜਾਂ ਸਰਕਾਰੀ ਹੁੰਦੇ

ਅਤੇ ਇਹਨਾਂ ਦੋਨਾਂ ਦੇ ਮੁਕਾਬਲੇ ਕੇ ਵੀ ਸਕੂਲ ਦਾ ਕੀ ਸਟੈਂਡਡ ਹੈਗਾ ਜੀ ਠੀਕ ਹੈ ਜੀ ਥੈਂਕ ਯੂ